ਹੈਲੋ ਸਤਿ ਸ਼੍ਰੀ ਅਕਾਲ ਜੀ

ਬਸ ਵਧੀਆ ਤੁਸੀਂ ਸੁਣਾਓ ਹਾਂਜੀ ਦੋ ਤਿੰਨ ਮਹੀਨੇ ਤਾਂ ਲੱਗ ਹੀ ਜਾਣੇ ਹੈ ਹਾਂ ਬਸ ਲਾਗੇ ਹੀ ਕੋਈ ਕਿਰਾਏ 'ਤੇ ਮਕਾਨ ਹੈ ਤੇ ਘਰ ਹੈ ਉੱਥੇ ਮਤਲਬ ਰਹਿਣਾ ਹੁਣ ਹਾਂਜੀ ਹਾਂਜੀ ਹਾਂਜੀ ਉਹ ਤਾਂ ਹੈ ਇੱਧਰ ਫਿਰ ਇੱਧਰ ਵੀ ਕਿੱਥੇ ਰੱਖਣਾ ਹਾਂ ਜਿੱਦਾਂ ਅੱਜ ਕੱਲ੍ਹ ਚੱਲਿਆ ਕਰਦਾ ਜੋ ਮਤਲਬ ਹੂ ਉਹੀ ਸਭ ਜਿੱਦਾਂ ਸਾਰੇ ਮਤਲਬ ਘਰ ਦੇ ਵੱਡੇ ਕਹਿਣਗੇ ਉਦਾਂ ਹੀ ਹੋਣਾ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਰੀ ਤਿਆਰੀ ਕਰਵਾ ਕੇ ਫਿਰ ਹੀ ਆਉਣਾ ਇੱਧਰ ਹਾਂਜੀ ਹਾਂਜੀ ਸੈੱਟ ਕਾਫੀ ਟਾਈਮ ਲੱਗ ਜਾਣਾ ਦੋ ਤਿੰਨ ਮਹੀਨੇ ਲੱਗ ਹੀ ਜਾਣੇ ਆ ਹਾਂ ਉਹ ਤਾਂ ਕਰਨਾ ਹੀ ਪੈਣਾ ਠੀਕ ਹੈ ਫਿਰ